ਮੈਂ ਬਹੁਤ ਥਾਵਾਂ 'ਤੇ ਘੁੰਮਣ ਗਿਆ ਹਾਂ ਗੱਲ ਕਰ ਲਈਏ ਅੱਜ ਅੰਮ੍ਰਿਤਸਰ ਦੀ ਕਿ ਜਦੋਂ ਮੈਂ ਅੰਮ੍ਰਿਤਸਰ ਗਿਆ ਤਾਂ ਸਭ ਤੋਂ ਪਹਿਲਾਂ ਹਰਿਮੰਦਰ ਸਾਹਿਬ ਮੱਥਾ ਟੇਕਿਆ ਉੱਥੇ ਜਾ ਕੇ ਇਕ ਸ਼ਾਂਤੀ ਜੋ ਮਿਲਦੀ ਹੈ ਮਨ ਨੂੰ ਉਹ ਬਹੁਤ ਹੀ ਅਲੱਗ ਲੈਵਲ 'ਤੇ ਮਿਲਦੀ ਹੈ ਕਿ ਉਸ ਤੋਂ ਬਾਅਦ ਮੱਥਾ ਟੇਕ ਕੇ ਦਰਬਾਰ ਸਾਹਿਬ ਦਰਸ਼ਨ ਕਰਕੇ ਮੈਂ ਵਾਹਗਾ ਬਾਰਡਰ ਦੇਖਣ ਚਲੇ ਗਿਆ ਕਿ ਜੋ ਵੀ ਅੱਧੇ ਘੰਟੇ ਦੀ ਦੂਰੀ 'ਤੇ ਸਥਿਤ ਹੈ ਉੱਥੇ ਕੀ ਦਿਖਾਇਆ ਗਿਆ ਹੈ ਕਿ ਆਪਣੇ ਦੋਨੋਂ ਦੇਸ਼ਾਂ ਦੀ ਪਾਕਿਸਤਾਨ ਅਤੇ ਭਾਰਤ ਦੀ ਬਾਰਡਰ ਲਾਇਨ ਦਿਖਾਈ ਗਈ ਹੈ ਜਿਸ ਵਿੱਚ ਅ ਬਹੁਤ ਹੀ ਲੋਕਾਂ ਦਾ ਉਤਸ਼ਾਹ ਸੀਗਾ ਅਤੇ ਮੈਂ ਵੀ ਉਹਦੇ ਵਿੱਚ ਜਾ ਕੇ ਸ਼ਾਮਿਲ ਹੋਇਆ ਪਰ ਗੱਲ ਕਰ ਲਈਏ ਕਿ ਆਪਣਾ ਖਾਣੇ ਪੀਣੇ ਦੀ ਤਾਂ ਅੰਮ੍ਰਿਤਸਰ ਵਿਖੇ ਬਹੁਤ ਹੀ ਅਲੱਗ ਅਲੱਗ ਪ੍ਰਕਾਰ ਦੇ ਖਾਣੇ ਵੀ ਮੈਂ ਖਾਧੇ